ਹਾਂਜੀ ਬਾਈ ਜੀ ਕੀ ਹਾਲ ਹੈ ਜੀ ਵੀਰ ਜੀ ਬਾਈ ਜੀ ਅਸੀਂ ਨਾ ਆਪਣਾ ਬਠਿੰਡੇ ਤੋਂ ਸਾਈਡ ਤੋਂ ਨਾ ਨਵੇਂ ਆਏ ਸੀਗੇ ਪਟਿਆਲੇ ਵਿੱਚ ਹਾਂ ਅਤੇ ਉਹ ਆਪਣੇ ਉੱਥੇ ਤੁਹਾਡੇ ਜਾਣਕਾਰ ਹੋਣਗੇ ਬਠਿੰਡੇ ਤੋਂ ਪਟਿਆਲੇ ਨੂੰ ਉਹ ਮੈਨੂੰ ਪੁੱਛਦੇ ਸੀ ਕਹਿੰਦੇ ਉਹਨਾਂ ਨੂੰ ਪੁੱਛ ਲਿਓ ਤੁਸੀਂ ਨਾ ਕਿ ਪਟਿਆਲੇ ਸ਼ਹਿਰ ਬਾਰੇ ਕਿ ਬਜ਼ਾਰ ਬਜ਼ੂਰ 'ਚ ਅਸੀਂ ਨਾ ਕਦੇ ਕੱਪੜੇ ਤਾਂ ਅੱਗੇ ਤਾਂ ਬਠਿੰਡੇ ਵਗੈਰਾ ਤੋਂ ਹੀ ਲੈਂਦੇ ਸੀਗੇ ਅਤੇ ਆਪਾਂ ਪਟਿਆਲੇ ਮਾਰਕੀਟ ਤੋਂ ਹੁਣ ਲੈਣਾ ਸਮਾਨ ਸਮੂਨ ਵਿਆਹ ਸੀਗਾ ਅਤੇ ਉਹ ਮਾੜੇ ਜਿਹਾ ਤੁਹਾਨੂੰ ਹੈਗੀ ਆ ਨੌਲਜ ਦੱਸ ਸਕਦੇ ਹੋ ਕਿੱਥੇ ਕਿੱਥੇ ਦੱਸੋ ਭਾਅ ਜੀ ਠੀਕ ਆ ਬਾਈ ਜੀ ਅੱਛਾ ਠੀਕ ਹੈ ਜੀ ਠੀਕ ਆ ਅਤੇ ਰੇਟ ਵੱਧ ਭਾਅ ਜੀ ਠੀਕ ਹੈ ਠੀਕ ਹੈ

ਅੱਛਾ ਠੀਕ ਹੈ ਠੀਕ ਹੈ ਠੀਕ ਹੈ ਅਤੇ ਉੱਥੇ ਗੱਡੀ ਵਗੈਰਾ ਵਗ ਜਾਂਦੀ ਹੈ ਜੀ ਠੀਕ ਆ ਠੀਕ ਆ ਠੀਕ ਆ ਜੀ ਅੱਛਾ ਪੱਗਾਂ ਦੀਆਂ ਦੁਕਾਨਾਂ ਬਹੁਤ ਨੇ ਠੀਕ ਆ ਅਤੇ ਆਪਣੇ ਲੇਡੀਜ਼ ਸੂਟ ਵਗੈਰਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਫਿਰ ਬਾਜ਼ਾਰ ਤਾਂ ਫਿਰ ਤੁਹਾਨੂੰ ਜੀ ਓ ਪਤਾ ਹੋਊਗਾ ਜੀ ਸ਼ੋਪ ਸ਼ੂਪ ਦਾ ਜਿਹੜੀ ਤੋਂ ਆਪਾਂ ਲੈਣਾ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ

ਏ ਸੀ ਮਾਰਕਿਟ ਜੀ ਠੀਕ ਹੈ ਕੋਈ ਨੀ ਬਾਈ ਜੀ ਫਿਰ ਮੈਂ ਤੁਹਾਨੂੰ ਨਾ ਜਦੋਂ ਜਾਣਾ ਹੋਇਆ ਸ਼ੋਪਿੰਗ ਲਈ ਤੁਹਾਨੂੰ ਜਰੂਰ ਲੈ ਜੂਗਾ ਇੱਕ ਵਾਰੀ ਤੁਸੀਂ ਮੈਨੂੰ ਦੋ ਤਿੰਨ ਦੁਕਾਨਾਂ ਦਾ ਇੱਕ ਵਾਰੀ ਜਿਕਰ ਕਰਾ ਦਿਓ ਨਾਲ ਲੈ ਜਾਇਓ ਚਲੋ ਠੀਕ ਆ ਭਾਅ ਜੀ ਬਹੁਤ ਬਹੁਤ ਧੰਨਵਾਦ